ਜਿਵੇਂ ਕਿ ਸਾਡੇ ਖੇਤਰ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ ਪਰ ਮੈਂ ਜਿਹੜਾ ਉਹ ਹਿੰਦੂ ਧਰਮ ਤੋਂ ਨਾਲ ਜੁੜੀ ਹੋਈ ਹਾਂ ਮੇਰੇ ਪਿਤਾ ਜੀ ਨੇ ਮੈਨੂੰ ਆਪਣੇ ਘਰ ਦੇ ਰੀਤੀ ਰਿਵਾਜ ਬਾਰੇ ਦੱਸਿਆ ਹੈ ਜਿਵੇਂ ਸਾਡੀ ਕੁਲ ਦੀ ਦੇਵੀ ਜਵਾਲਾ ਜੀ ਹੈ ਤਾਂ ਸਾਡੇ ਜਦੋਂ ਵੀ ਕੋਈ ਨਵਾਂ ਬੱਚਾ ਪੈਦਾ ਹੁੰਦਾ ਹੈ ਜਾਂ ਕਿਸੇ ਦਾ ਵਿਆਹ ਹੁੰਦਾ ਹੈ ਤਾਂ ਉਹ ਨਵਾਂ ਜੋੜਾ ਜਿਹੜਾ ਉਹ ਜਵਾਲਾ ਜੀ ਜਾ ਕੇ ਹੀ ਮੱਥਾ ਟੇਕਦਾ ਹੈ ਅਤੇ ਘਰ ਦੇ ਵਿੱਚ ਹੋਰ ਵੀ ਜਿਹੜੇ ਰੀਤੀ ਰਿਵਾਜ ਹੈ ਉਹ ਅਲੱਗ ਅਲੱਗ ਤਿਉਹਾਰਾਂ 'ਤੇ ਕੀਤੇ ਜਾਂਦੇ ਹਨ ਇਵੇਂ ਹੀ ਅਸੀਂ ਆਪਣੇ ਮਾਤਾ ਪਿਤਾ ਤੋਂ ਜਿਹੜੀ ਇਹ ਚੀਜ਼ਾਂ ਸਿੱਖ ਰਹੇ ਹਾਂ ਅਤੇ ਇਵੇਂ ਹੀ ਪੀੜੀ ਦਰ ਪੀੜੀ ਇਹ ਚੀਜ਼ਾਂ ਜਿਹੜੀਆਂ ਅੱਗੇ ਚੱਲਦੀਆਂ ਰਹਿਣੀਆਂ ਹੈੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਜਿਹੜਾ ਹੈ ਇਹਨਾਂ ਰੀਤੀ ਰਿਵਾਜਾਂ ਬਾਰੇ ਜਿਹੜਾ ਦੱਸਣਾ ਹੈ ਕਿ ਅਸੀਂ ਕਿਹੜੇ ਧਰਮ ਨਾਲ ਜੁੜੇ ਹਾਂ ਅਤੇ ਅਸੀਂ ਕਿਹੜੇ ਦੇਵੀ ਦੇਵਤੇ ਨੂੰ ਪੂਜਣਾ ਹੈ